ਅਸੀਂ ਚਾਰ ਭੈਣ ਭਰਾ ਹਾਂ ਦੋ ਭੈਣਾਂ ਅਤੇ ਦੋ ਭਰਾ ਹਨ ਵੱਡੇ ਭਰਾ ਦਾ ਨਾਮ ਜਗਦੇਵ ਸਿੰਘ ਹੈ ਛੋਟੇ ਭਰਾ ਦਾ ਨਾਮ ਕੁਲਵਿੰਦਰ ਸਿੰਘ ਹੈ ਅਤੇ ਛੋਟੀ ਭੈਣ ਦਾ ਨਾਮ ਜਸਵੀਰ ਕੌਰ ਹੈ ਅਤੇ ਮੇਰਾ ਨਾਮ ਸੁਰਿੰਦਰ ਕੌਰ ਹੈ ਮੇਰਾ ਵੱਡਾ ਭਰਾ ਸ਼ਟਰਿੰਗ ਦਾ ਕੰਮ ਕਰਦਾ ਹੈ ਅਤੇ ਛੋਟਾ ਭਰਾ ਪਹਿਲਾਂ ਮਿਲਟਰੀ ਵਿੱਚ ਸੀਗਾ ਅਤੇ ਹੁਣ ਪੰਚਕੂਲਾ ਪੁਲਿਸ ਵਿੱਚ ਹੈ ਅਤੇ ਅਸੀਂ ਅਤੇ ਮੇਰੀ ਭੈਣ ਹਾਊਸ ਵਾਈਫ਼ ਹੈ ਅਤੇ ਮੈਂ ਵੀ ਹਾਊਸ ਵਾਈਫ਼ ਹੀ ਹਾਂ ਅਸੀਂ ਚਾਰੋਂ ਭੈਣ ਭਰਾ ਸਾਰੇ ਫੰਕਸ਼ਨ ਵਗੈਰਾ 'ਤੇ ਇਕੱਠੇ ਜਾਂਦੇ ਹਾਂ ਇਕੱਠੇ ਰਹਿੰਦੇ ਹਾਂ ਮਤਲਬ ਇਕੱਠੇ ਅਸੀਂ ਰਲ਼ ਮਿਲਕੇ ਰਹਿੰਦੇ ਹਾਂ ਅਤੇ ਅਸੀਂ ਸਿੱਖ ਧਰਮ ਨਾਲ਼ ਸਬੰਧ ਰੱਖਦੇ ਹਾਂ